ਹਾਂਜੀ ਕਾਫੀ ਕਾਫੀ ਯੋਗਦਾਨ ਪਾਇਆ ਗਿਆ ਪੰਜਾਬ ਸਿੱਖਿਆ ਨੂੰ ਉੱਚ ਉਤ ਉੱਚਾ ਚੱਕਣ ਲਈ ਪਹਿਲਾਂ ਤਾਂ ਸਕੂਲ ਜਿਹੜੇ ਹੈ ਰੀਕਨਸਟਰਕਟ ਕੀਤੇ ਗਏ ਹੈ ਉਹਨਾਂ ਵਿੱਚ ਫੈਸਿਲਟੀਸ ਜੋ ਕਿ ਪਹਿਲਾਂ ਨਹੀਂ ਸੀ ਹੁਣ ਕਾਫੀ ਕਮਰੇ ਮੋਡਰਨਾਈਜੇਸ਼ਨ ਕਰ ਦਿੱਤੇ ਹੈ ਔਰ ਸਮਾਰਟ ਰੂਮ ਕਲਾਸਰੂਮ ਸਮਾਟ ਰੂਮ 'ਚ ਚੇਂਜ ਹੋ ਗਏ ਨੇ ਅਤੇ ਕਾਫੀ ਹੋਰ ਫੈਸਿਲਟੀਸ ਦਿੱਤੀਆਂ ਜਾ ਰਹੀਆਂ ਜੋ ਕਿ ਬੜੀ ਚੰਗੀ ਗੱਲ ਹੈ ਇਸ ਦੇ ਨਾਲ ਨਾਲ ਬੱਚੇ ਨੂੰ ਸ ਸਟੱਡੀ ਦੇ ਨਾਲ ਨਾਲ ਸਪੋਰਟਸ ਐਕਟੀਵਿਟਿਸ 'ਚ ਵੀ ਇੰਨਡਲਜ਼ ਕੀਤਾ ਜਾ ਰਿਹਾ ਅੱਗੇ ਪੁਸ਼ ਕੀਤਾ ਜਾ ਰਿਹਾ ਵੀ ਹਾਂ ਬੱਚਾ ਸਗੋਂ ਸਟੱਡੀ ਦੇ ਨਾਲ ਨਾਲ ਆਪਣੇ ਖੇਡਾਂ 'ਚ ਵੀ ਯੋਗਦਾਨ ਪਾਏ ਜੋ ਕਿ ਇੱਕ ਅੱਛੀ ਗੱਲ ਹੈ ਕਿਉਂਕਿ ਆਪਣੇ ਦੇਸ਼ ਲਈ ਉਹ ਖੇਡਾਂ ਵਿੱਚ ਵੀ ਨਾਮ ਕਮਾ ਸਕਦਾ ਹੈ ਨਾਲ ਨਾਲ ਸਟੱਡੀ ਦੇ ਸੋ ਹੋਰ ਇਸ ਦੇ ਨਾਲ ਨਾਲ ਲਾਇ ਲਾਇਬਰੇਰੀ ਬਣਾਈਆਂ ਗਈਆਂ ਕੰਪਿਊਟਰ ਲੈਬ ਹੋ ਗਈ ਹੈ ਸੋ ਬੱਚਿਆਂ ਦਾ ਇੰਟਰਸਟ ਹੋਰ ਵੱਧ ਗਿਆ ਹੈ ਤਾਂ ਇਹ ਇੱਕ ਬਹੁਤ ਚੰਗੀ ਗੱਲ ਹੈ